ਇੱਕ ਖੂਹ ਤੋਂ ਪਾਣੀ ਕੱਢਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਾਲਟੀ ਚਾਹੀਦੀ ਹੈ ਫਿਰ ਇੱਕ ਬਹੁਤ ਮਜ਼ਬੂਤ ਰੱਸੀ ਹੋਣੀ ਚਾਹੀਦੀ ਹੈ ਉਸ ਰੱਸੀ ਨੂੰ ਬਾਲਟੀ ਨਾਲ ਬੰਨ੍ਹੋ ਅਤੇ ਬਾਲਟੀ ਨੀਚੇ ਖੂਹ 'ਤੇ ਲੈ ਕੇ ਜਾਓ ਅਤੇ ਖੂਹ ਦਾ ਪਾਣੀ ਤੁਸੀਂ ਭਰ ਸਕਦੇ ਹੋ ਪਰ ਇਹ ਕੰਮ ਔਰਤਾਂ ਨੂੰ ਕਰਨਾ ਪੈਂਦਾ ਅਤੇ ਔਰਤਾਂ ਲਈ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਸੀ ਪੁਰਾਣੇ ਟਾਈਮ ਵਿੱਚ ਇੱਦਾਂ ਹੀ ਖੂਹ ਤੋਂ ਪਾਣੀ ਕੱਢਿਆ ਜਾਂਦਾ ਸੀ ਬਟ ਅੱਜ ਕੱਲ੍ਹ ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਵਿਗਿਆਨ ਇੰਨਾ ਜ਼ਿਆਦਾ ਅੱਗੇ ਵੱਧ ਚੁੱਕਿਆ ਹੈ ਕਿ ਹੁਣ ਇਹ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਹੁਣ ਖੂਹ ਤੋਂ ਪਾਣੀ ਕੱਢਣ ਲਈ ਤੁਹਾਨੂੰ ਬਾਲਟੀ ਲੈ ਕੇ ਨਹੀਂ ਜਾਣਾ ਪਏਗਾ ਇਸ ਲਈ ਤੁਸੀਂ ਇਕ ਇਲੈਕਟਰਿਕ ਮੋਟਰ ਲਗਵਾ ਸਕਦੇ ਹੋ ਇਲੈਕਟਰੀਸ਼ਨ ਤੁਹਾਡੇ ਘਰ ਆਏਗਾ ਤੁਹਾਨੂੰ ਇੱਕ ਇਲੈਕਟਰਿਕ ਮੋਟਰ ਲਗਾ ਦਏਗਾ ਜਿੱਥੇ ਵੀ ਤੁਹਾਡਾ ਖੂਹ ਹੈ ਉੱਥੇ ਇੱਕ ਇਲੈਕਟਰਿਕ ਮੋਟਰ ਨੀਚੇ ਲੱਗ ਜਾਏਗੀ ਉਹ ਇਲੈਕਟਰਿਕ ਮੋਟਰ ਕੀ ਕਰਦੀ ਹੈ ਉਹ ਪਾਣੀ ਨੂੰ ਨਿੱਚੋਂ ਉੱਪਰ ਤੱਕ ਖਿੱਚਦੀ ਹੈ ਉੱਪਰ ਇੱਕ ਟੈਂਕੀ ਹਰ ਘਰ ਦੇ ਉੱਪਰ ਟੈਂਕੀ ਲੱਗੀ ਹੁੰਦੀ ਹੈ ਉਹ ਟੈਂਕੀ ਤੱਕ ਖੂਹ ਦਾ ਪਾਣੀ ਟੈਂਕੀ ਤੱਕ ਚਲਾ ਜਾਏਗਾ ਪਾਈਪਾਂ ਰਾਹੀਂ ਅਤੇ ਫਿਰ ਉਹ ਪਾਣੀ ਬਹੁਤ ਆਸਾਨੀ ਨਾਲ ਵਰਤੋਂ ਕਿ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਇਸ ਤਰ੍ਹਾਂ ਖੂਹ ਤੋਂ ਪਾਣੀ ਕੱਢਣ ਲਈ ਹੁਣ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਇਲੈਕਟਰਿਕ ਮੋਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ